ਜਿਹੜਾ ਸਾਡਾ ਇਲਾਕਾ ਹੈ ਨਾ ਫਤਿਹਗੜ੍ਹ ਸਾਹਿਬ ਦਾ ਇਹ ਹੈ ਹੀ ਧਾਰਮਿਕ ਇਲਾਕਾ ਇੱਥੇ ਨਾ ਅਲੱਗ ਅਲੱਗ ਧਰਮਾਂ ਦੇ ਕਾਫ਼ੀ ਪੁਰਾਣੇ ਇਤਿਹਾਸਕ ਜਗ੍ਹਾ ਹੈਗੀਆਂ ਨੇ ਜਿਵੇਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਆ ਜਿੱਥੇ ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਹੈ ਨਾ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਏ ਉਹਨਾਂ ਦੀ ਜਗ੍ਹਾ ਹੈ ਉਹਨਾਂ ਦਾ ਸਥਾਨ ਹੈ ਜਿੱਥੋਂ ਜਿਸ ਕਰਕੇ ਸਿੱਖ ਸੰਗਤਾਂ ਇੱਥੇ ਆਉਂਦੀਆਂ ਨੇ ਇੱਕ ਉਰੇ ਰੋਜ਼ਾ ਸ਼ਰੀਫ ਹੈ ਜਿੱਥੇ ਕਿ ਮੁਸਲਮਾਨ ਧਰਮ ਦੇ ਲੋਕ ਬਹੁਤ ਆਉਂਦੇ ਨੇ ਉੱਥੇ ਵੀ ਸਾਲ ਬਾਅਦ ਮੇਲਾ ਲੱਗਦਾ ਰੋਜ਼ਾ ਸ਼ਰੀਫ ਦਾ ਅਤੇ ਇੱਕ ਉਰੇ ਨਾ ਜੈਨ ਤੀਰਥ ਹੈ ਚਕੇਸ਼ਵਰੀ ਦੇਵੀ ਦਾ ਮੰਦਰ ਹੈ ਉੱਥੇ ਵੀ ਦੂਰੋਂ ਨੇੜਿਓਂ ਜਿਹੜੇ ਜੈਨ ਧਰਮ ਨਾਲ ਸੰਬੰਧਿਤ ਲੋਕ ਨੇ ਉਹ ਆ ਕੇ ਉੱਥੇ ਆਪਣਾ ਸੀਸ ਨਿਵਾਉਂਦੇ ਨੇ ਕਹਿ ਲਉ ਪੂਜਾ ਕਰਦੇ ਨੇ ਅਤੇ ਜਿਸ ਕਰਕੇ ਇਹ ਜਿਹੜਾ ਧਰਮਾਂ ਦਾ ਕੇਂਦਰ ਹੋਣ ਕਰਕੇ ਜਿਵੇਂ ਕਹਿ ਲਉ ਕਿ ਸਿੱਖ ਧਰਮ ਦੇ ਵਿੱਚ ਵੀ ਬਹੁਤ ਵੱਡਾ ਸਥਾਨ ਹੈ ਸ਼ਹੀਦੀ ਦਾ ਅਤੇ ਜਿਹੜਾ ਮੁਸਲਮਾਨ ਦੇ ਧਰਮ ਨੇ ਰੋਜ਼ਾ ਸ਼ਰੀਫ ਇਹਨਾਂ ਦੇ ਵਿੱਚ ਵੀ ਕਾਫ਼ੀ ਮੰਨੇ ਜਾਂਦੇ ਰੋਜ਼ਾ ਸ਼ਰੀਫ ਦਾ ਅਤੇ ਇੱਧਰ ਜੈਨ ਧਰਮ ਤਾਂ ਕਾਫ਼ੀ ਜਿਹੜਾ ਪ੍ਰਯਟਨ ਆ ਉਹ ਇਹਦੇ ਕਰਕੇ ਦੂਰੋਂ ਨੇੜਿਓਂ ਲੋਕ ਆਉਂਦੇ ਨੇ ਇਹਨੂੰ ਦੇਖਣ 'ਤੇ ਇੱਕ ਮੁਗਲਾਂ ਦਾ ਉਰੇ ਬਾਗ਼ ਹੈ ਜਿਹਨੂੰ ਆਮ ਖ਼ਾਸ ਬਾਗ਼ ਕਹਿੰਦੇ ਨੇ ਅਤੇ ਜਿਹੜੀ ਉਹਦਾ ਆਰਕੀਟੈਕਚਰ ਆ ਮੁਗ਼ਲ ਆਰਕੀਟੈਕਚਰ ਉਹ ਦੇਖਣ ਵਾਸਤੇ ਵੀ ਲੋਕ ਆਉਂਦੇ ਨੇ ਅਤੇ ਫ਼ਿਲਮਾਂ ਦੀ ਸ਼ੂਟਿੰਗ ਵੀ ਹੁੰਦੀ ਆ ਇੱਥੇ ਅਤੇ ਮੁਗ਼ਲ ਰਾਜ ਦਾ ਕੇਂਦਰ ਹੋਣ ਕਰਕੇ ਸਰਹੰਦ ਵਿੱਚ ਹੋਰ ਵੀ ਛੋਟੇ ਛੋਟੇ ਕਈ ਮਕਬਰੇ ਇਸ ਤਰ੍ਹਾਂ ਹੈਗੇ ਨੇ ਜੋ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਅਤੇ ਉੱਥੇ ਵੀ ਕੋਈ ਨਾ ਕੋਈ ਪ੍ਰਯਟਨ ਜਾਂ ਪ੍ਰਯਟਕ ਆਉਂਦੇ ਰਹਿੰਦੇ ਨੇ ਜਾਂ ਫਿਰ ਫ਼ਿਲਮਾਂ ਦੀ ਗਾਣਿਆਂ ਦੀ ਸ਼ੂਟਿੰਗ ਦੇ ਲਈ ਜਿਹੜੇ ਡਾਇਰੈਕਟਰ ਵਗੈਰਾ ਉਹਨੂੰ ਪ੍ਰੈਫਰ ਕਰਦੇ ਆ ਅਤੇ ਉੱਥੇ ਆਉਂਦੇ ਨੇ